ਪੰਜਾਬ ਵਿੱਚ ਨਵੇਂ ਤਰ੍ਹਾਂ ਦੀਆਂ ਟੈਕਨੋਲੋਜੀਆਂ ਸਿਸਟਮ ਆ ਰਹੀਆਂ ਹਨ ਜਿੱਦਾਂ ਕਿ ਅਸੀਂ ਪਹਿਲਾਂ ਬੱਤੀ ਵਾਸਤੇ ਲਾਲਟੇਨ ਮੋਮਬੱਤੀਆਂ ਵਰਤਦੇ ਸੀਗੇ ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਬੱਲਬ ਲਾਈਟਾਂ ਟਿਊਬ ਲਾਈਟਾਂ ਆ ਗਈਆਂ ਹਨ ਜਿਹੜੀਆਂ ਕਿ ਕਰੰਟ 'ਤੇ ਚੱਲਦੀਆਂ ਸਨ ਜਿੱਦਾਂ ਕਿ ਉਹਨੂੰ ਪੈਦਾ ਕਰਨ ਵਾਸਤੇ ਕੋਲੇ ਦਾ ਵਰਤੋਂ ਕੀਤੀ ਜਾਂਦੀ ਸੀ ਜਿਹੜੀ ਕਿ ਇੱਕ ਨੈਚੁਰਲ ਰਿਸੋਰਸ ਹੈ ਜਿਹਦੀ ਉਹ ਕੱਟੀ ਜਾ ਰਹੀ ਹੈ ਪਰ ਹੁਣ ਉਹਨੂੰ ਵੀ ਚੇਂਜ ਕਰਕੇ ਉਹ ਸੋਲਰ ਸੈੱਲ ਵਾਲੇ ਪਾਸੇ ਪੰਜਾਬ ਦੀ ਸਰਕਾਰ ਕਾਫ਼ੀ ਵਧੀਆ ਉਪਰਾਲਾ ਕਰ ਰਹੀ ਹੈ ਜਿੱਦਾਂ ਕਿ ਧੁੱਪ ਦੀ ਰੋਸ਼ਨੀ ਤੋਂ ਬੱਤੀ ਪੈਦਾ ਕਰਕੇ ਅਸੀਂ ਘਰ ਦੇ ਸਾਰੇ ਕੰਮ ਕਰ ਸਕਦੇ ਹਾਂ ਬੱਤੀਂ ਟਿਊਬ ਲਾਈਟ ਬੱਲਬ ਪੱਖੇ ਏ ਸੀ ਸਭ ਸੂਰਜ ਦੀ ਗਰਮੀ ਨਾਲ ਹੀ ਚੱਲਣਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਕਿ ਇੱਕ ਬਹੁਤ ਵੱਡਾ ਉਪਰਾਲਾ ਹੈ ਤਾਂ ਕਿ ਜੇ ਕੋਲਾ ਪੈਦਾ ਹੋਣਾ ਖ਼ਤਮ ਵੀ ਹੋ ਜਾਵੇ ਪਰ ਫਿਰ ਵੀ ਬੱਤੀ ਦੀ ਜਿਹੜੀ ਯੂ ਵਰਤੋਂ ਹੈ ਉਹ ਨਹੀਂ ਘੱਟ ਸਕਦੀ ਇਸ ਕਰਕੇ ਕਾਫ਼ੀ ਵਧੀਆ ਉਪਰਾਲੇ ਹੋ ਰਹੇ ਹਨ ਧੰਨਵਾਦ